ਹੈਲੋ ਮੇਰਾ ਨਾਮ ਅੰਸ਼ਿਕਾ ਗੁਪਤਾ ਹੈ ਅਤੇ ਮੈਂ ਉਬਰ ਕੰਪਨੀ ਨਾਲ ਗੱਲ ਕਰ ਸਕਦੀ ਹਾਂ ਮੈਂ ਤੁਹਾਡੇ ਡਰਾਈਵਰ ਨੂੰ ਫ਼ੋਨ ਕੀਤਾ ਸੀ ਅਤੇ ਇੱਕ ਦਿਨ ਪਹਿਲਾਂ ਹੀ ਆਪਣੀ ਗੱਡੀ ਬੁੱਕ ਕੀਤੀ ਸੀ ਮੈਂ ਇੱਕ ਅਵਾਰਡ ਫੰਕਸ਼ਨ 'ਤੇ ਜਾਣਾ ਹੈ ਅਤੇ ਮੈਂ ਤੁਹਾਡੇ ਡਰਾਈਵਰ ਨੂੰ ਅੱਧੇ ਘੰਟੇ ਪਹਿਲੇ ਦਾ ਟਾਈਮ ਦਿੱਤਾ ਸੀ ਤਾਂ ਕਿ ਮੈਂ ਲੇਟ ਨਾ ਹੋ ਜਾਂ ਮੈਂ ਦੋ ਘੰਟਿਆਂ ਤੋਂ ਖੜ੍ਹੀ ਉਹਦਾ ਇੰਤਜ਼ਾਰ ਕਰ ਰਹੀ ਹਾਂ ਅਤੇ ਤੁਸੀਂ ਆਪ ਸੋਚੋ ਮੇਰਾ ਅਵਾਰਡ ਫੰਕਸ਼ਨ ਕਦ ਦਾ ਸ਼ੁਰੂ ਹੋ ਚੁੱਕਿਆ ਫਿਰ ਵੀ ਮੈਂ ਹਾਲੇ ਵੀ ਖੜ੍ਹੀ ਤਿਆਰ ਹੋ ਕੇ ਉਹਦਾ ਇੰਤਜ਼ਾਰ ਕਰ ਰਹੀ ਹਾਂ ਅਤੇ ਉਹ ਹਾਲੇ ਤੱਕ ਪਹੁੰਚਿਆ ਹੀ ਨਹੀਂ ਮੈਂ ਤਾਂ ਆਹ ਵੀ ਸੋਚਿਆ ਸੀ ਕਿ ਮੈਂ ਜਾਂਦੇ ਜਾਂਦੇ ਰਸਤੇ 'ਚ ਆਪਣੇ ਦੋਸਤਾਂ ਨੂੰ ਲੈ ਜਾਵਾਂਗੀ ਬੱਟ ਤੁਹਾਡਾ ਡਰਾਈਵਰ ਤਾਂ ਮੈਨੂੰ ਹੀ ਲੈਣ ਨਹੀਂ ਆਇਆ ਮੈਂ ਕਦੀ ਉਰੇ ਹੀ ਗਰੀਨ ਐਵਨਿਊ ਕਲੋਨੀ ਦੇ ਗੇਟ ਜਿਹੜਾ ਐਡਰੈੱਸ ਮੈਂ ਤੁਹਾਡੀ ਐਪ 'ਚ ਮੈਂਸ਼ਨ ਕੀਤਾ ਸੀ ਉੱਧਰ ਵੇਟ ਕਰ ਰਹੀ ਹਾਂ ਬੱਟ ਫੇਰ ਵੀ ਤੁਹਾਡਾ ਡਰਾਈਵਰ ਹਾਲੇ ਤੱਕ ਆਇਆ ਨਹੀਂ ਮੈਂ ਸੋਚਿਆ ਸੀ ਕਿ ਮੈਂ ਅਵਾਰਡ ਫੰਕਸ਼ਨ ਤੋਂ ਆ ਕੇ ਆਪਣੇ ਇੱਕ ਸਹੇਲੀ ਦੇ ਵਿਆਹ ਵਿੱਚ ਜਾਣਾ ਹੈ ਜੋ ਮੇਰੀ ਬਹੁਤ ਹੀ ਸਗੀ ਹੈ ਬੱਟ ਤੁਹਾਡੇ ਡਰਾਈਵਰ ਕਰਕੇ ਮੈਂ ਆਪਣਾ ਅਵਾਰਡ ਫੰਕਸ਼ਨ ਹੀ ਅਟੈਂਡ ਨਹੀਂ ਕਰ ਪਾ ਰਹੀ ਹਾਂ ਵਿਆਹ ਤਾਂ ਦੂਰ ਦੀ ਗੱਲ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਆਹ ਦੱਸ ਦਿਉ ਕਿ ਉਹਨੇ ਅੱਜ ਆਉਣਾ ਵੀ ਹੈ ਜਾਂ ਨਹੀਂ ਮੈਂ ਇੱਕ ਤਾਂ ਐਡਵਾਂਸ ਬੁਕਿੰਗ ਕਰ ਚੁੱਕੀ ਹਾਂ ਉਹ ਵੀ ਤੁਹਾਨੂੰ ਸਾਰੇ ਪੈਸੇ ਦੇ ਚੁੱਕੀ ਹਾਂ ਤਾਂ ਕਰਕੇ ਮੈਂ ਕੈਂਸਲ ਵੀ ਨਹੀਂ ਕਰ ਸਕਦੀ ਅਤੇ ਕੋਈ ਹੋਰ ਡਰਾਈਵਰ ਬੁੱਕ ਵੀ ਨਹੀਂ ਕਰ ਸਕਦੀ ਕਿਰਪਾ ਕਰਕੇ ਤੁਸੀਂ ਮੈਨੂੰ ਬਿਲਕੁਲ ਸਹੀ ਸਮਾਂ ਦੱਸ ਦਿਉ ਤਾਂ ਕਿ ਜੋ ਮੈਂ ਉੱਥੇ ਜਾਣ ਜੋਗੀ ਹੋ ਸਕਾਂ ਧੰਨਵਾਦ